ਛੇ ਦਸ ਉੱਨੀ ਸੌ ਬਿਆਸੀ ਦਸ ਚਾਰ ਦੋ ਹਜ਼ਾਰ ਚਾਰ ਛੇ ਨੌ ਦੋ ਹਜ਼ਾਰ ਸੌਲ੍ਹਾਂ ਬਾਰ੍ਹਾਂ ਉੱਨੀ ਸੌ ਅਠਵੰਜਾ ਵੀਹ ਇੱਕ ਉੱਨੀ ਸੌ ਸਤਾਸੀ